ਸਮੇਂ ਦੇ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਘਟਦੀ ਜਾ ਰਹੀ ਹੈ ਕਿਉਂਕਿ ਜਿਹੜੀ ਅੱਜ ਕੱਲ੍ਹ ਦੀ ਪੜ੍ਹਾਈ ਹੈ ਉਹ ਸੀ ਬੀ ਐੱਸ ਸੀ ਲੇਵਲ ਦੀ ਹੋਣੀ ਸ਼ੁਰੂ ਹੋ ਗਈ ਹੈ ਉਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਕਿਤੇ ਪਿੱਛੇ ਲਗਾ ਦਿੱਤਾ ਗਿਆ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਗਲਿਸ਼ ਦੇ ਹੀ ਸਬਜੈਕਟ ਰੱਖੇ ਜਾਂਦੇ ਹੈ ਪੰਜਾਬੀ ਭਾਸ਼ਾਵਾਂ ਦੇ ਵਿੱਚ ਕੋਈ ਸਬਜੈਕਟ ਹੀ ਨਹੀਂ ਹੁੰਦਾ ਅਤੇ ਜਿਹੜੀ ਪੰਜਾਬੀ ਲੈਂਗਜੂਏਜ ਤੀਸਰੇ ਨੰਬਰ ਜਾਂ ਦੂਸਰੇ ਜਾਂ ਤੀਸਰੇ ਨੰਬਰ 'ਤੇ ਹੁੰਦੀ ਹੈ ਜੋ ਕਿ ਮੈਂ ਵੇਖਿਆ ਹੈ ਅਤੇ ਅੱਜ ਕੱਲ੍ਹ ਜਿਹੜਾ ਸੱਭਿਆਚਾਰ ਦੇ ਵਿੱਚ ਗਾਣਿਆਂ ਦੇ ਵਿੱਚ ਤੁਸੀਂ ਲੈ ਲਓ ਕਿ ਜੋ ਵੀ ਕੋਈ ਗਾਣੇ ਗਾਉਂਦੇ ਆ ਉਹ ਪੰਜਾਬੀ ਗਾਣੇ ਦੇ ਵਿੱਚ ਇੰਗਲਿਸ਼ ਵਾਲੇ ਰੈਪ ਮਿਕਸ ਕਰੇ ਹੁੰਦੇ ਹੈ ਜੋ ਕਿ ਸੁਣਨ 'ਚ ਵੀ ਸਮਝ ਨਹੀਂ ਆਉਂਦੇ ਕਿ ਇਹ ਕੀ ਕਹਿ ਰਿਹਾ ਪੰਜਾਬੀ ਮਤਲਬ ਕਿ ਪਹਿਲਾਂ ਅਸੀਂ ਇਕੱਠੇ ਬੈਠ ਕੇ ਦੇਖ ਲੈਂਦੇ ਹੁੰਦੇ ਸੀ ਕਿ ਵੀ ਕੀ ਹੈ ਅਤੇ ਫਿਲਮਾਂ ਦੇ ਵਿੱਚ ਵੀ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਇੰਗਲਿਸ਼ ਮਿਕਸ ਕਰਨ ਲੱਗ ਗਏ ਹੈ ਇਸ ਦੇ ਨਾਲ ਸਾਡੀ ਪੰਜਾਬੀ ਭਾਸ਼ਾ ਬਹੁਤ ਪਿੱਛੇ ਜਾ ਰਹੀ ਹੈ ਕਲਚਰ ਖਤਮ ਹੁੰਦਾ ਜਾ ਰਿਹਾ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਪੰਜਾਬੀ ਦੇ ਵਿੱਚ ਕਹਿਣਾ ਹੈ ਇੰਗਲਿਸ਼ ਯੂਜ ਜ਼ਿਆਦਾ ਵੱਧ ਗਿਆ ਹੈ ਇੰਗਲਿਸ਼ ਦੀ ਪੜ੍ਹਾਈ ਜ਼ਿਆਦਾ ਹੀ ਵੱਧ ਗਈ ਹੈ ਅਤੇ ਮੈਂ ਤਾਂ ਇਹੀ ਕਹੂੰਗਾ ਵੀ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਜਾਵੇ ਤਾਂ ਜੋ ਆਪਣਾ ਪੰਜਾਬੀ ਸੱਭਿਆਚਾਰ ਬਚੇ